ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਡਾਂਸ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਮੈਂ ਭੰਗੜੇ ਦੇ ਵਿੱਚ ਹਿੱਸਾ ਲਿਆ ਸੀ ਜੋ ਕਿ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਜਦੋਂ ਮੈਂ ਉਸ ਵਿੱਚ ਹਿੱਸਾ ਲਿਆ ਤਾਂ ਮੈਨੂੰ ਬੋਹਤ ਖੁਸ਼ੀ ਹੋਈ ਮੇਰੀਆਂ ਅੰਦਰਲੀਆਂ ਭਾਵਨਾਵਾਂ ਬਹੁਤ ਮੰਨ ਲਓ ਮੈਂ ਬਿਆਨ ਬੋਲ ਕੇ ਵੀ ਬਿਆਨ ਨਹੀਂ ਕਰ ਸਕਦਾ ਕਿ ਉਸ ਟਾਈਮ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਤੇ ਉਹ ਮੁਕਾਬਲਾ ਅਸੀਂ ਲਗਭਗ ਇੱਕ ਮਹੀਨਾ ਉਹਦੀ ਰਿਹਸਲ ਕਰ ਇੱਕ ਮਹੀਨੇ ਬਾਅਦ ਜਦੋਂ ਅਸੀਂ ਮੁਕਾਬਲਾ ਕਰਨ ਗਏ ਤਾਂ ਅਸੀਂ ਬਹੁਤ ਹੀ ਮਿਹਨਤ ਦੇ ਨਾਲ਼ ਭੰਗੜਾ ਪਾਇਆ ਤੇ ਡਿਸਟ੍ਰਿਕਟ ਦੇ ਵਿੱਚ ਪਹਿਲ ਨੰਬਰ ਤੇ ਵੀ ਆਏ ਉਸ ਸਮੇਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਧੰਨਵਾਦ ਜੀ